ਮੈਂ ਵਿਜੇ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਦੇ ਸਮੇਂ ਵਿੱਚ ਸਾਨੂੰ ਆਪਣੇ ਆਪਣੇ ਰਿਕਾਰਡ ਨੂੰ ਕਿਵੇਂ ਸੰਭਾਲ ਕੇ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਆਪਣੇ ਰਿਕਾਰਡ ਨੂੰ ਸੰਭਾਲ ਕੇ ਰੱਖੋਂਗੇ ਤਾਂ ਹੀ ਜ਼ਿੰਦਗੀ ਵਿੱਚ ਤੁਹਾਡੇ ਕਾਗਜ਼ ਤੁਹਾਡੇ ਸਾਰੇ ਹੀ ਡਾਕੂਮੈਂਟਸ ਸਰਟੀਫਿਕੇਟ ਸੰਭਾਲੇ ਜਾਣਗੇ ਅਤੇ ਉਹਨਾਂ ਨੂੰ ਸਮਾਂ ਆਉਣ 'ਤੇ ਉਹਨਾਂ ਦੀ ਜ਼ਰੂਰਤ ਦਾ ਮੁੱਲ ਮੁੱਕ ਜਾਵੇਗਾ ਇਸ ਕਰਕੇ ਕਿਹਾ ਜਾਂਦਾ ਹੈ ਕਿ ਅਸੀਂ ਸਾਰੇ ਹੀ ਆਪਣੇ ਆਪਣੇ ਸਿਸਟਮ ਦੇ ਨਾਲ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੇ ਸਰਟੀਫਿਕੇਟਾਂ ਨੂੰ ਜਾਂ ਆਪਣੇ ਆਪਣੇ ਡਾਟੇ ਨੂੰ ਸਾਂਭ ਕੇ ਕਿਸ ਤਰ੍ਹਾਂ ਰੱਖਣਾ ਹੈ ਸਭ ਤੋਂ ਪਹਿਲਾਂ ਸਾਡੇ ਕੋਲ ਜਿੰਨੇ ਕੁ ਜ਼ਰੂਰੀ ਦਸਤਾਵੇਜ਼ ਹਨ ਉਹਨਾਂ ਲਈ ਇੱਕ ਅੱਜ ਕੱਲ੍ਹ ਵਧੀਆ ਬਾਜ਼ਾਰੋਂ ਇੱਕ ਫਾਇਲ ਖਰੀਦੀ ਜਾਏ ਜਿਹੜੀ ਕਿ ਜਿੱਪਰ ਦੇ ਅੰਦਰ ਹੋਵੇ ਉਹਨਾਂ ਸਾਰੇ ਹੀ ਕਾਗਜ਼ਾਂ ਨੂੰ ਉਸ ਵਿੱਚ ਰੱਖ ਕੇ ਬਾਹਰੋਂ ਜਿੱਪ ਲਗਾ ਕੇ ਉਹਨਾਂ ਨੂੰ ਲੜੀਵਾਰ ਤਰੀਕੇ ਨਾਲ ਸਜਾ ਕੇ ਰੱਖੋ ਅਤੇ ਲੋੜ ਪੈਣ 'ਤੇ ਉਸ ਨੂੰ ਲੜੀ ਮੁਤਾਬਿਕ ਹੀ ਉਸ ਵਿੱਚੋਂ ਕੱਢ ਕੇ ਤੁਸੀਂ ਕਿਤੇ ਉਸ ਦੀ ਜ਼ਰੂਰਤ ਨੂੰ ਪੂਰਾ ਕਰ ਸਕਦੇ ਹੋ ਇਸ ਤਰ੍ਹਾਂ ਇੱਕ ਤਾਂ ਤੁਹਾਡਾ ਰਿਕਾਰਡ ਸੰਭਾਲਿਆ ਜਾਵੇਗਾ ਦੂਜਾ ਤੁਹਾਨੂੰ ਸਮੇਂ ਸ ਮੁਤਾਬਕ ਚੀਜ਼ ਦੀ ਜ਼ਰੂਰਤ ਪੂਰੀ ਹੋ ਜਾਵੇਗੀ ਧੰਨਵਾਦ